ਗਰਭ ਅਵਸਥਾ ਦੇ ਦੌਰਾਨ ਬੱਚੇ ਦੀ ਦਿਮਾਗੀ ਵਿਕਾਸ ਪ੍ਰਕਿਰਿਆ ਸ਼ੁਰੂ ਹੁੰਦੀ ਹੈ ਇਹ ਗਰਭਵਤੀ ਮਹਿਲਾ ਸਿਹਤ ਪੋਸ਼ਣ ਅਤੇ ਵਾਤਾਵਰਨ ਤੋਂ ਪ੍ਰਭਾਵਿਤ ਹੁੰਦਾ ਹੈ ਜਨਮ ਦੇ ਬਾਅਦ ਸਰੀਰਕ ਵਿਕਾਸ ਦੇ ਇਲਾਵਾ ਇੱਕ ਮਾਨਵ ਬੱਚੇ ਦੇ ਦਿਮਾਗ ਦਾ ਵਿਕਾਸ ਉਸਦੇ ਭਵਿੱਖ ਦੇ ਪੱਧਰ ਦੀ ਬੁੱਧੀ ਅਤੇ ਜੀਵਨ ਗੁਣਵੱਤਾ ਦਾ ਪ੍ਰਸਤੁਤ ਕਰਦਾ ਹੈ ਮਾਪਿਆਂ ਨੂੰ ਚਾਹੀਦਾ ਹੈ ਕਿ ਸਰਕਾਰੀ ਡਿਸਪੈਂਸਰੀ ਵਿੱਚ ਹਰ ਬੁੱਧਵਾਰ ਨੂੰ ਆਪਣੇ ਬੱਚਿਆਂ ਦਾ ਬਣਦਾ ਟੀਕਾਕਰਨ ਜ਼ਰੂਰ ਕਰਵਾਉਣ ਗਰਭਵਤੀ ਔਰਤ ਦੀ ਸਿਹਤ ਸੁਰੱਖਿਆ ਲਈ ਵੀ ਟੀਕਾਕਰਨ ਬਹੁਤ ਮਹੱਤਵਪੂਰਨ ਹੈ ਜਨਮ ਤੋਂ ਲੈ ਕੇ ਤੇਰ੍ਹਾਂ ਮਹੀਨੇ ਦੇ ਹੋਣ ਤੱਕ ਟੀਕਾਕਰਨ ਦੀ ਰੁਟੀਨ ਜ਼ਰੂਰੀ ਹੈ ਦੋ ਤਿੰਨ ਅਤੇ ਚਾਰ ਮਹੀਨੇ ਤੱਕ ਦੇ ਬੱਚੇ ਦਾ ਟੀਕਾਕਰਨ ਡੀ ਟੀ ਏ ਪੀ ਆਈ ਪੀ ਵੀ ਐਚ ਆਈ ਬੀ ਵੈਕਸੀਨ ਜ਼ਰੂਰੀ ਦੇਣੀ ਚਾਹੀਦੀ ਹੈ ਪੀ ਸੀ ਵੀ ਬੀ ਸੀ ਜੀ ਵੈਕਸੀਨ ਹੈਪੇਟਾਈਟਿਸ ਬੀ ਵੈਕਸੀਨ ਖਤਰਨਾਕ ਬਿਮਾਰੀਆਂ ਤੋਂ ਬਚਾਉਣ ਲਈ ਡਿਪਟੀਰੀਆ ਟੈਟਨਸ ਕਾਲੀ ਖਾਂਸੀ ਹਿਬ ਪੋਲੀਓ ਖਸਰਾ ਕਨਪੇੜੇ ਹਰਬੈਲਾ ਅਤੇ ਛੋਟੀ ਮਾਤਾ ਤੋਂ ਜ਼ਰੂਰ ਟੀਕਾਕਰਨ ਕਰਵਾਉਣਾ ਚਾਹੀਦਾ ਹੈ ਇਸ ਵਿੱਚ ਬਿਲਕੁਲ ਵੀ ਮਾਪਿਆਂ ਵੱਲੋਂ ਅਣਗਹਿਲੀ ਨਹੀਂ ਕੀਤੀ ਜਾਣੀ ਚਾਹੀਦੀ